ਪਹਿਲਾਂ ਹਰ ਇੱਕ ਸ਼ੋਪਿੰਗ ਕਰਨ ਦੇ ਲਈ ਬਾਜ਼ਾਰ ਜਾਣਾ ਜ਼ਰੂਰੀ ਹੁੰਦਾ ਸੀ ਪਰ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਨੇ ਹਰ ਇੱਕ ਦਾ ਕੰਮ ਆਸਾਨ ਕਰ ਦਿੱਤਾ ਹੈ ਅਸੀਂ ਘਰ ਬੈਠੇ ਕੋਈ ਵੀ ਚੀਜ਼ ਕਿੰਨੀ ਵੀ ਪ੍ਰਾਈਸ 'ਤੇ ਕਦੋਂ ਵੀ ਮੰਗਵਾ ਸਕਦੇ ਹਾਂ ਇਸ ਔਨਲਾਈਨ ਸ਼ੋਪਿੰਗ ਨੇ ਹਰ ਇੱਕ ਦਾ ਕੰਮ ਆਸਾਨ ਕਰ ਦਿੱਤਾ ਹੈ ਔਨਲਾਈਨ ਸ਼ੋਪਿੰਗ ਜਿਵੇਂ ਮੀਸੋ ਐਮਾਜ਼ੋਨ ਫਲਿਪਕਾਰਟ 'ਤੇ ਕੀਤੀ ਜਾ ਸਕਦੀ ਹੈ ਐਮਾਜ਼ੋਨ ਫਲਿਪਕਾਰਟ ਦੇ ਰਾਹੀਂ ਅਸੀਂ ਹਰ ਇੱਕ ਚੀਜ਼ ਨੂੰ ਆਰਡਰ ਕਰ ਸਕਦੇ ਹਾਂ ਅਤੇ ਕੁਛ ਹੀ ਦਿਨਾਂ ਦੇ ਵਿੱਚ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਬਹੁਤ ਹੀ ਘੱਟ ਰੇਟ 'ਤੇ ਚੀਜ਼ ਮਿਲ ਸਕਦੀ ਹੈ ਔਨਲਾਈਨ ਸ਼ੋਪਿੰਗ ਨੇ ਪੂਰਾ ਬਾਜ਼ਾਰ ਦੀ ਸਥਿਤੀ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਪਹਿਲਾਂ ਔਨਲਾਈਨ ਸ਼ੋਪਿੰਗ ਵਰਗੀਆਂ ਸਹੂਲਤਾਂ ਨਹੀਂ ਸੀ ਇਸ ਕਰਕੇ ਕੋਈ ਵੀ ਚੀਜ਼ ਲੈਣ ਦੇ ਲਈ ਬਾਜ਼ਾਰ ਜਾਣਾ ਪੈਂਦਾ ਸੀ ਇ ਪਰ ਔਨਲਾਈਨ ਖਰੀਦਦਾਰੀ ਕਰਨ ਦੇ ਨਾਲ ਬਹੁਤ ਹੀ ਇਸਦੀਆਂ ਹਾਨੀਆਂ ਵੀ ਹਨ ਔਨਲਾਈਨ ਸ਼ੋਪਿੰਗ ਦੇ ਵਿੱਚ ਬਹੁਤ ਹੀ ਬੁਰੀਆ ਚੀਜ਼ਾਂ ਵੀ ਹਨ ਜਿਵੇਂ ਔਨਲਾਈਨ ਸ਼ੋਪਿੰਗ ਕਰਨ 'ਤੇ ਕਈ ਵਾਰ ਕੋਈ ਕੱਪੜਾ ਮੰਗਵਾਉਣ ਦੇ ਨਾਲ ਕੱਪੜੇ ਦਾ ਸਟਫ ਕਿਵੇਂ ਦਾ ਹੈ ਉਹ ਨਹੀਂ ਪਤਾ ਚੱਲ ਸਕਦਾ ਕੋਈ ਫਰਨੀਚਰ ਲਗਾਉਣਾ ਔਨਲਾਈਨ ਸ਼ੋਪਿੰਗ ਕਰਕੇ ਤਾਂ ਔਨਲਾਈਨ ਬਿਨਾ ਹੱਥ ਲਗਾਏ ਕੋਈ ਫਰਨੀਚਰ ਨਹੀਂ ਖਰੀਦ ਸਕਦੇ ਇਸ ਤਰ੍ਹਾਂ ਬਹੁਤ ਹੀ ਬੁਰੀਆਂ ਚੀਜ਼ਾਂ ਵੀ ਹਨ ਔਨਲਾਈਨ ਸ਼ੋਪਿੰਗ ਦੀਆਂ